ਦਸ ਅਕਤੂਬਰ ਉੱਨੀ ਸੌ ਵੀਹ ਪੰਜ ਪੰਜ ਜਨਵਰੀ ਉੱਨੀ ਸੌ ਇੱਕੀ ਅੱਠ ਮਾਰਚ ਉੱਨੀ ਸੌ ਤੇਈ ਦਸ ਅਪ੍ਰੈਲ ਉੱਨੀ ਸੌ ਉੱਨੀ ਸੌ ਅਠਾਰਾਂ ਪੰਦਰਾਂ ਜਨਵਰੀ ਉੱਨੀ ਸੌ ਸਤਾਰਾਂ